ਮੋਹਾਲੀ ਜ਼ਿਲ੍ਹਾ ਪੰਜਾਬ ਦਾ ਇੱਕ ਵਿਕਸਿਤ ਜ਼ਿਲ੍ਹਾ ਹੈ ਰੋਜ਼ਗਾਰ ਅਤੇ ਵਿੱਦਿਅਕ ਸੰਸਥਾਵਾਂ ਇਸ ਵਿੱਚ ਸ਼ਾਮਲ ਹਨ ਜ਼ਿਲ੍ਹੇ ਮੋਹਾਲੀ ਵਿੱਚ ਹਰ ਵਰਗ ਦੇ ਲੋਕ ਰਹਿੰਦੇ ਹਨ ਜੋ ਅਲੱਗ ਅਲੱਗ ਭਾਸ਼ਾਵਾਂ ਦੀ ਵਰਤੋਂ ਕਰਦੇ ਹਨ ਪ੍ਰਸ਼ਾਸਨ ਵਲੋਂ ਸਮੇਂ ਸਮੇਂ ਉੱਤੇ ਜ਼ਿਲ੍ਹੇ ਵਿੱਚ ਸੱਭਿਆਚਾਰਕ ਮੇਲੇ ਅਤੇ ਧਾਰਮਿਕ ਸਮਾਗਮ ਤਿਉਹਾਰ ਮਨਾਏ ਜਾਂਦੇ ਹਨ ਜਿਨ੍ਹਾਂ ਵਿੱਚ ਹਰ ਵਰਗ ਦੇ ਲੋਕ ਆਉਂਦੇ ਹਨ ਜਿਸ ਨਾਲ ਭਾਈਚਾਰਕ ਸਾਂਝ ਵਿੱਚ ਵਾਧਾ ਹੁੰਦਾ ਹੈ ਲੋਕ ਇੱਕ ਦੂਜੇ ਦੀਆਂ ਭਾਸ਼ਾਵਾਂ ਸੁਣਦੇ ਹਨ ਅਤੇ ਉਹਨਾਂ ਬਾਰੇ ਜਾਣੂ ਹੁੰਦੇ ਹਨ ਰੀਤੀ ਰਿਵਾਜਾਂ ਬਾਰੇ ਪਤਾ ਲੱਗਦਾ ਹੈ ਸਾਡੇ ਇਲਾਕੇ ਵਿੱਚ ਅਕਸਰ ਗੱਡੀਆਂ ਵਾਲੇ ਕਬੀਲੇ ਅਤੇ ਬਾਹਰੋਂ ਲੋਕ ਆ ਕੇ ਵੱਸਦੇ ਹਨ ਜ਼ਿਲ੍ਹੇ 'ਚ ਇਲਾਜ ਅਤੇ ਰੋਜ਼ਗਾਰ ਦੇ ਲਈ ਅਤੇ ਪੜਾਈ ਲਈ ਬਾਹਰੋਂ ਲੋਕ ਆਉਂਦੇ ਹਨ ਇਸ ਤਰ੍ਹਾਂ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਦੇ ਆਉਣ ਨਾਲ਼ ਭਾਸ਼ਾਵਾਂ ਬਦਲਦੀਆਂ ਰਹਿੰਦੀਆਂ ਹਨ